ਸਕੂਲਾਂ ਦੇ ਵਿੱਚ ਹਰੇਕ ਹੀ ਵਿਸ਼ਾ ਪੜ੍ਹਾਇਆ ਜਾਂਦਾ ਹੈ ਅਧਿਆਪਕ ਚੰਗੇ ਹਨ ਪੜ੍ਹੇ ਲਿਖੇ ਹਨ ਵਿਸ਼ੇ ਤਾਂ ਸਕੂਲ ਦੇ ਵਿੱਚ ਹਰੇਕ ਹੀ ਵਿਸ਼ਾ ਪੜ੍ਹਾਇਆ ਜਾਂਦਾ ਹੈ ਪੰਜਾਬੀ ਹਿੰਦੀ ਸਾਇੰਸ ਮੈਥ ਇੰਗਲਿਸ਼ ਸਾਰੇ ਵਿਸ਼ੇ ਹੀ ਜ਼ਰੂਰੀ ਹਨ ਬੱਚਿਆਂ ਦੇ ਲਈ ਸਾਰੇ ਵਿਸ਼ੇ ਹੀ ਪੜ੍ਹਾਏ ਜਾਂਦੇ ਹਨ ਅਧਿਆਪਕ ਵੀ ਸਾਰੇ ਚੰਗੇ ਅਤੇ ਪੜ੍ਹੇ ਲਿਖੇ ਹਨ ਤਾਂ ਵਿਸ਼ੇ ਬੱਚੇ ਨੂੰ ਆਪਣੇ ਆਪ ਹੀ ਸਾਰੇ ਸਮਝ ਆਉਣੇ ਸ਼ੁਰੂ ਹੋ ਜਾਂਦੇ ਹਨ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਐਚੂਲ਼ੀ ਬਹੁਤ ਹੀ ਵਧੀਆ ਟੀਚਰ ਹੁੰਦੇ ਹਨ ਸਾਰੇ ਟੀਚਰ ਹੀ ਡਿਗਰੀਆਂ ਵਾਲੇ ਹੁੰਦੇ ਹਨ ਅੱਛੀਆਂ ਡਿਗਰੀਆਂ ਲੈ ਕੇ ਪੜ੍ਹੇ ਲਿਖੇ ਟੀਚਰ ਹੁੰਦੇ ਹਨ ਜੋ ਕਿ ਸਕੂਲਾਂ ਦੇ ਵਿੱਚ ਪੜ੍ਹਾਉਣ ਵਾਸਤੇ ਲਗਾਏ ਜਾਂਦੇ ਹਨ ਬੱਚਿਆਂ ਨੂੰ ਬੜੀ ਹੀ ਵਧੀਆ ਸਰਕਾਰੀ ਸਕੂਲਾਂ ਦੇ ਵਿੱਚ ਸਮਝ ਆਉਂਦੀ ਹੈ ਬੱਚੇ ਸਾਡੇ ਅੱਛੇ ਅੱਛੇ ਨੰਬਰ ਲੈ ਕੇ ਪਾਸ ਹੋ ਰਹੇ ਹਨ ਹਰੇਕ ਵਿਸ਼ਾ ਬੱਚਾ ਇੰਟ੍ਰਸਟ ਨਾਲ ਪੜ੍ਹ ਰਿਹਾ ਹੈ ਕਿਉਂਕਿ ਹਰੇਕ ਵਿਸ਼ੇ ਦਾ ਟੀਚਰ ਅਲੱਗ ਅਲੱਗ ਹੈ ਉਸ ਟੀਚਰ ਨੇ ਉਸ ਵਿਸ਼ੇ ਦੇ ਉੱਤੇ ਪੂਰਾ ਐਕਸਪੀਰੀਐਂਸ ਕੀਤਾ ਹੋਇਆ ਹੈ ਉਸ ਨੂੰ ਪੜ੍ਹਾਉਣ ਦਾ ਤਰੀਕਾ ਅਲੱਗ ਹੁੰਦਾ ਹੈ ਸਾਇੰਸ ਟੀਚਰ ਨੇ ਸਾਇੰਸ ਪੜ੍ਹੀ ਹੈ ਉਹ ਸਾਇੰਸ ਵਧੀਆ ਤਰੀਕੇ ਨਾਲ ਪੜ੍ਹਾ ਰਹੇ ਹੈ ਪੂਰੇ ਫੋਰਮੁਲੇਸ ਨਾਲ ਪੜ੍ਹਾ ਰਹੇ ਹੈ ਮੈਥ ਟੀਚਰ ਨੇ ਮੈਥ ਨਾਲ ਐੱਮ ਏ ਐੱਮ ਐੱਸ ਈ ਕੀਤੀ ਹੈ ਅਤੇ ਉਹ ਮੈਥ ਵਧੀਆ ਪੜ੍ਹਾ ਰਹੇ ਨੇ ਬੱਚਿਆਂ ਨੂੰ ਅੱਛੀ ਤਰ੍ਹਾਂ ਸਮਝ ਆ ਰਹੀ ਹੈ ਟੀਚਰ ਸਾਰੇ ਹੀ ਬਹੁਤ ਵਧੀਆ ਹਨ ਸਕੂਲਾਂ ਦੇ ਵਿੱਚ ਜੇਕਰ ਅਸੀਂ ਪ੍ਰਾਈਵੇਟ ਸਕੂਲਾਂ ਦੀ ਗੱਲ ਕਰੀਏ ਤਾਂ ਓਥੇ ਬੱਚਿਆਂ ਨੂੰ ਬੜੀ ਦਿੱਕਤ ਆਉਂਦੀ ਹੈ ਪੜ੍ਹਨ ਦੇ ਵਿੱਚ ਓਥੋਂ ਦੇ ਟੀਚਰ ਕੀ ਹੁੰਦੇ ਹੈ ਇੱਕ ਬੀ ਏ ਐੱਮ ਏ ਟੀਚਰ ਹੁੰਦੇ ਹੈ ਉਨ੍ਹਾਂ ਨੂੰ ਹਰੇਕ ਵਿਸ਼ਾ ਦੇ ਦਿੱਤਾ ਜਾਂਦਾ ਹੈ ਪੜ੍ਹਾਉਣ ਦੇ ਲਈ ਬੱਚਿਆਂ ਨੂੰ ਮੈਥ ਵਾਲੇ ਮੈਥ ਵਾਲੇ ਨੂੰ ਵੀ ਹਿੰਦੀ ਮੈਥ ਹਿੰਦੀ ਵਾਲਾ ਟੀਚਰ ਮੈਥ ਪੜ੍ਹਾਈ ਜਾਂਦਾ ਹੈ ਮੈਥ ਵਾਲਾ ਟੀਚਰ ਸਾਇੰਸ ਪੜ੍ਹਾਈ ਜਾਂਦਾ ਹੈ ਟੀਚਰ ਇੱਕ ਹੈ ਸਾਰੇ ਵਿਸ਼ੇ ਪੜ੍ਹਾ ਰਿਹਾ ਹੈ ਐੱਮ ਏ ਬੀ ਏ ਉਹਦੀ ਕੀਤੀ ਹੈ ਬੱਚਿਆਂ ਨੂੰ ਕੁਛ ਵੀ ਪੱਲੇ ਨਹੀਂ ਪੈ ਰਿਹਾ ਹੈਗਾ ਬੱਚੇ ਬਹੁਤ ਪ੍ਰਾਈਵੇਟ ਸਕੂਲਾਂ ਵਿੱਚ ਬਹੁਤ ਦਿੱਕਤ ਮਹਿਸੂਸ ਕਰ ਰਹੇ ਹਨ ਪਰ ਸਰਕਾਰੀ ਸਕੂਲਾਂ ਦਾ ਰਿਜ਼ਲਟ ਹੰਡਰਡ ਪਰਸੈਂਟ ਹੈ ਅਤੇ ਸਾਡੇ ਬੱਚੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹ ਕੇ ਅੱਜ ਸਾਡੇ ਬੱਚੇ ਮੈਡੀਕਲ ਨੌਨ ਮੈਡੀਕਲ ਨਾਲ ਪੜ੍ਹ ਰਹੇ ਹਨ ਅਤੇ ਨਾਇਟੀ ਨਾਈਨ ਪਰਸੈਂਟ ਨੰਬਰ ਲੈ ਕੇ ਪਾਸ ਹੋ ਰਹੇ ਹਨ